ਪੰਜਾਬ ਵਿੱਚ ਕਲਾ ਅਤੇ ਸ਼ਿਲਪਕਾਰੀ ਖੇਤਰ ਵਿੱਚ ਕਾਫੀ ਹੀ ਸਾਰੀਆਂ ਸਿੱਖਿਆ ਦਿੱਤੀਆਂ ਜਾਂਦੀਆਂ ਨੇਗੀਆ ਸਰਕਾਰ ਦੁਆਰਾ ਇਹਦੇ ਕਾਫੀ ਉਪਰਾਲੇ ਵੀ ਕੀਤੇ ਗਏ ਨੇਗੇ ਹਰੇਕ ਸਕੂਲ ਕਾਲਜ ਅਤੇ ਹੋਰ ਸਿੱਖਿਆ ਸਥਾਨਾਂ ਵਿੱਚ ਇਹਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਇਹਦੇ ਸਰਟੀਫਿਕੇਟ ਕੋਰਸ ਵੀ ਹੁੰਦੇ ਨੇਗੇ ਡਿਪਲੋਮਾ ਵੀ ਹੁੰਦਾ ਜਿਹੜੀ ਕਿ ਤਿੰਨ ਸਾਲਾਂ ਦੇ ਵੀ ਹੋ ਸਕਦੇ ਨੇ ਇੱਕ ਮਹੀਨੇ ਦਾ ਵੀ ਹੋ ਸਕਦਾ ਛੇ ਮਹੀਨਿਆਂ ਦਾ ਵੀ ਹੋ ਸਕਦਾ ਅਤੇ ਇਹ ਕਾਫੀ ਦਿਨਾਂ ਦਾ ਵੀ ਹੋ ਸਕਦਾ ਹੈ ਅਤੇ ਇਹ ਆਪਣੇ ਇੰਟਰਸਟ ਦੇ ਅਕੋਰਡਿੰਗ ਡਿਪੈਂਡ ਕਰਦਾ ਹੈ ਕਿ ਅਸੀਂ ਕਿਵੇਂ ਇਸ ਤਰ੍ਹਾਂ ਆਪਣੀ ਕਲਾ ਦਿਖਾ ਕੇ ਅਤੇ ਸ਼ਿਲਪਕਾਰੀ ਖੇਤਰ ਵਿੱਚ ਆਪਣਾ ਇੱਕ ਵੱਖਰਾ ਹੀ ਸਥਾਨ ਬਣਾ ਸਕਦੇ ਹਾਂ